ਸ਼੍ਰੀ ਨਿਵਾਸਨ ਰਾਮਾਨੁਜਨ ਇੱਕ ਬਹੁਤ ਹੀ ਪ੍ਰਸਿੱਧ ਭਾਰਤੀ ਗਣਿਤ ਸ਼ਾਸਤਰੀ ਹੋਏ ਹਨ ਜਿਨ੍ਹਾਂ ਦਾ ਜਨਮ ਅਠਾਰਾਂ ਸੌ ਸਤਾਸੀ ਨੂੰ ਹੋਇਆ ਅਤੇ ਉੱਨੀ ਸੌ ਵੀਹ ਤੱਕ ਉਹਨਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਉਹਨਾਂ ਉਹਨਾਂ ਨੇ ਪਿਓਰ ਮੈਥਿਮੈਟਿਕਸ ਵਿੱਚ ਕੋਈ ਫੋਰਮਲ ਟ੍ਰੇਨਿੰਗ ਨਹੀਂ ਲਿੱਤੀ ਜਦਕਿ ਆਪਣੀਆਂ ਐਕਸਪੀਰੀਅੰਸ ਦੇ ਨਾਲ ਹੀ ਉਹ ਬਹੁਤ ਹੀ ਪ੍ਰਸਿੱਧ ਹੋਏ ਉਹਨਾਂ ਨੇ ਬਹੁਤ ਵਧੀਆ ਡਿਸਕਵਰੀਜ਼ ਕੀਤੀਆਂ ਖੋਜਾਂ ਕੀਤੀਆਂ ਜਿਨ੍ਹਾਂ ਵਿੱਚੋਂ ਹੈ ਨੰਬਰ ਥਿਊਰੀ ਇਨਫਨਾਈਟ ਸੀਰੀਜ਼ ਅਤੇ ਕੰਟੀਨਿਊਡ ਫਰੈਕਸ਼ਨ ਇਹਨਾਂ ਵਿੱਚ ਉਹਨਾਂ ਨੇ ਬਹੁਤ ਖੋਜਾਂ ਕੀਤੀਆਂ ਇਸ ਦੇ ਨਾਲ ਨਾਲ ਸੀ ਵੀ ਰਮਨ ਇੱਕ ਭਾਰਤੀ ਭੌਤਿਕ ਵਿਗਿਆਨੀ ਸੀ ਜਿਨ੍ਹਾਂ ਦਾ ਜਨਮ ਅਠਾਰਾਂ ਸੌ ਅਠਾਸੀ ਨੂੰ ਹੋਇਆ ਅਤੇ ਉੱਨੀ ਸੌ ਸੱਤਰ ਤੱਕ ਉਹਨਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਉਹ ਇੱਕ ਭੌਤਿਕ ਵਿਗਿਆਨੀ ਸੀ ਜੋ ਰੋਸ਼ਨੀ ਫੈਲਾਉਣ ਦੇ ਖੇਤਰ ਵਿੱਚ ਆਪਣੇ ਕੰਮ ਲਈ ਜਾਣਿਆ ਜਾਂਦਾ ਸੀ ਇੱਕ ਸਪੈਕਟਰੋ ਗਰਾਫ ਦੀ ਵਰਤੋਂ ਕਰਦੇ ਹੋਏ ਜੋ ਉਸ ਨੇ ਵਿਕਸਤ ਕੀਤਾ ਉਸਨੇ ਅਤੇ ਉਸ ਦੇ ਵਿਦਿਆਰਥੀ ਕੇ ਐੱਸ ਕ੍ਰਿਸ਼ਨਨ ਨੇ ਖੋਜ ਕੀਤੀ ਕਿ ਜਦੋਂ ਪ੍ਰਕਾਸ਼ ਇੱਕ ਪਾਰਦਰਸ਼ੀ ਸਮੱਗਰੀ ਨੂੰ ਪਾਰ ਕਰਦਾ ਹੈ ਤਾਂ ਉਲਟੀ ਹੋਈ ਰੋਸ਼ਨੀ ਆਪਣੀ ਤਰੰਗ ਲੰਬਾਈ ਅਤੇ ਬਾਰੰਬਾਰਤਾ ਨੂੰ ਬਦਲਦੀ ਹੈ ਇਸ ਵਰਤਾਰੇ ਨੂੰ ਹੁਣ ਤੱਕ ਇੱਕ ਅਣਜਾਣ ਕਿਸਮ ਦੀ ਰੋਸ਼ਨੀ ਦੇ ਖਿਲਾਰਨ ਜਿਸ ਨੂੰ ਉਹ ਸੋਧਿਆ ਹੋਇਆ ਸਕੈਟਰਿੰਗ ਕਹਿੰਦੇ ਹਨ ਨੂੰ ਬਾਅਦ ਵਿੱਚ ਰਮਨ ਪ੍ਰਭਾਵ ਜਾਂ ਰਮਨ ਸਕੈਟਰਿੰਗ ਕਿਹਾ ਗਿਆ ਰਮਨ ਨੂੰ ਖੋਜ ਲਈ ਭੌਤਿਕ ਵਿਗਿਆਨ ਵਿੱਚ ਉੱਨੀ ਸੌ ਤੀਹ ਵਿੱਚ ਨੋਬਲ ਪੁਰਸਕਾਰ ਮਿਲਿਆ ਅਤੇ ਉਹ ਵਿਗਿਆਨ ਦੀ ਕਿਸੇ ਵੀ ਸ਼ਾਖਾ ਵਿੱਚ ਨੋਬਲ ਪੁਰਸਕਾਰ ਪ੍ਰਾਪਤ ਕਰਨ ਵਾਲੇ ਪਹਿਲੇ ਏਸ਼ੀਆਈ ਸਨ